ਹੈਲੋ ਜਸਦੀਪ ਕਿਵੇਂ ਆ ਮੈਂ ਨਾ ਨਵਾਂਸ਼ਹਿਰ ਤੋਂ ਰੋਪੜ ਆਉਣਾ ਸੀ ਪਿਛਲੀ ਵਾਰ ਨਾ ਮੈਂ ਕੈਬ ਬੁੱਕ ਕੀਤੀ ਸੀ ਉਹ ਨਾ ਡਰਾਈਵਰ ਥੋੜ੍ਹਾ ਠੀਕ ਨਹੀਂ ਸੀ ਮੀਨਿੰਗ ਨਾ ਉਹ ਤੇਜ਼ ਬਹੁਤ ਡਰਾਵਿੰਗ ਕਰ ਰਿਹਾ ਤਾ ਹੁਣ ਸ਼ਾਇਦ ਮੈਂ ਨਾ ਜਿਹੜਾ ਡਰਾਈਵਰ ਬੁੱਕ ਕੈਬ ਬੁੱਕ ਕੀਤੀ ਆ ਉਸ ਡਰਾਇਵਰ ਨੂੰ ਤੂੰ ਜਾਣਦੀ ਹੋਵੇਗੀ ਹਰਜਿੰਦਰ ਟ੍ਰੈਵਲਿੰਗ ਮ ਹੈਗੀ ਉਹ ਤੁਹਾਡੇ ਘਰ ਦੇ ਕੋਲ ਹੀ ਹੈ ਬਾਕੀ ਤੂੰ ਦੱਸ ਦੀ ਉਹਦਾ ਫੀਡਬੈਕ ਕਿਵੇਂ ਦਾ ਹੈ ਤੇਜ਼ ਤਾਂ ਨਹੀਂ ਚਲਾਉਂਦਾ ਜ਼ਿਆਦਾ ਅਤੇ ਮੈਨੂੰ ਰੇਟਿੰਗ ਵੀ ਦੱਸ ਦੀ ਬਾਕੀ ਮੈਨੂੰ ਇੱਕ ਵਾਰ ਪਤਾ ਕਰਕੇ ਨਾ ਕੋਲ ਕਰਦੀ